ਮੈਂ ਇੱਕ ਅਧਿਆਪਕ ਹਾਂ ਅਤੇ ਮੈਂ ਆਪਣਾ ਜਿਹੜਾ ਵਿਹਲਾ ਟਾਈਮ ਹੈ ਉਹ ਸੰਗੀਤ ਸੁਣਨਾ ਹੀ ਪਸੰਦ ਕਰਦੀ ਹਾਂ ਮੈਂ ਆਪਣੇ ਮੋਬਾਈਲ ਦੇ ਵਿੱਚ ਚੀ ਸਟਰੀਮਿੰਗ ਸੇਵਾ ਦੀ ਵਰਤੋਂ ਕਰਦੀ ਹਾਂ ਜੇ ਅਸੀਂ ਮੈਂ ਸੀ ਡੀ ਵੀ ਖਰੀਦਣ ਜਾਂਦੀ ਹਾਂ ਬਾਹਰੋਂ ਤਾਂ ਮੈਨੂੰ ਪਹਿਲੀ ਗੱਲ ਤਾਂ ਮੈਨੂੰ ਘਰੋਂ ਬਾਹਰ ਜਾਣਾ ਪੈਣਾ ਅਤੇ ਉਹਦੇ ਵਿੱਚ ਸੀ ਡੀ ਦੇ ਵਿੱਚ ਸਿਰਫ਼ ਲਿਮੀਟੇਡ ਗਾਣੇ ਹੋਣਗੇ ਜਿਹੜੇ ਕਿ ਮੈਂ ਸੁਣ ਸਕਦੀ ਹਾਂ ਅਤੇ ਘਰ ਬੈਠੇ ਹੀ ਮੋਬਾਈਲ ਦੇ ਵਿੱਚ ਫਿਰ ਜੇ ਮੈਂ ਇਹ ਵਾਲੀ ਸੇਵਾ ਦੀ ਵਰਤੋਂ ਕਰਦੀ ਹੈ ਤਾਂ ਮੈਨੂੰ ਅਨਲਿਮਿਟੇਡ ਗਾਣੇ ਸੁਣਨ ਦਾ ਮੌਕਾ ਮਿਲ ਜੇਗਾ ਜੇ ਮੇਰਾ ਨੈਟ ਖ਼ਤਮ ਹੋ ਗਿਆ ਹੈ ਅਤੇ ਮੈਂ ਵਾਈ ਫਾਈ ਵੀ ਔਨ ਕਰ ਸਕਦੀ ਹੈ ਅਤੇ ਮੈਂ ਆਪਣੇ ਗਾਣੇ ਸੁਣ ਸਕਦੀ ਹੈ ਜੇ ਮੈਂ ਆਪਣਾ ਕੋਈ ਹੋਰ ਫੇਵਰੇਟ ਸੋਂਗ ਸੁਣਨਾ ਹੋਵੇ ਉਹ ਵੀ ਮੈਂ ਇਸ ਸੇਵਾ ਦੀ ਵਰਤੋਂ ਕਰਕੇ ਸਿੱਖ ਸਕਦੀ ਹੈ ਜਦੋਂ ਕਿ ਜੇ ਮੈਂ ਆਪਣਾ ਕੋਈ ਵੀ ਵਧੀਆ ਗਾਣਾ ਸੁਣਨਾ ਹੋਵੇ ਅਤੇ ਉਹ ਸੀ ਡੀ ਦੇ ਵਿੱਚ ਨਾ ਹੋਣ ਦੀ ਬਦੋਲਤ ਮੈਨੂੰ ਦੁਬਾਰਾ ਵੀ ਜਾਣਾ ਪੈ ਸਕਦਾ ਹੈ ਅਤੇ ਇਹ ਇਹ ਮੇਰੇ ਵਾਸਤੇ ਬਹੁਤ ਔਖਾ ਹੈ ਜਿੱਦਾਂ ਰਾਤੀਂ ਅਸੀਂ ਕਿਸੇ ਵੇਲੇ ਵਿਹਲੇ ਬੈਠੇ ਹੁੰਦੇ ਹਾਂ ਅਤੇ ਸਾਡਾ ਮਨ ਕਰਦਾ ਹੈ ਕਿ ਅਸੀਂ ਆਪਣੇ ਵਧੀਆ ਗਾਣੇ ਸੁਣ ਸਕੀਏ ਤਾਂ ਕਿ ਅਸੀਂ ਥੋੜ੍ਹਾ ਜਿਹਾ ਆਪਣਾ ਮਨ ਹੋਰ ਪਾਸੇ ਲਗਾ ਸਕੀਏ ਪਰ ਜੇ ਕਰ ਇਹ ਸੇਵਾ ਅਤੇ ਅਸੀਂ ਵਰਤੋਂ ਨਾ ਕਰੀਏ ਤਾਂ ਅਸੀਂ ਉਹ ਕੰਮ ਨਹੀਂ ਕਰ ਸਕਦੇ ਜਦੋਂ ਕਿ ਸੀ ਡੀ ਖਰੀਦਣ ਦੇ ਵਿੱਚ ਸਾਨੂੰ ਉਹੀ ਗਾਣੇ ਵਾਰ ਵਾਰ ਰਿਪੀਟ ਕਰਨੇ ਪੈਂਦੇ ਆ ਉਹ ਸੁ ਗਾਣੇ ਸੁਣ ਕੇ ਅਸੀਂ ਆਦੀ ਹੋ ਜਾਂਦੇ ਅਤੇ ਦੁਬਾਰਾ ਮੇਰ ਸਾਡਾ ਉਹ ਗਾਣੇ ਸੁਣਨ ਨੂੰ ਮਨ ਨਹੀਂ ਕਰਦਾ ਹੈ ਜਦੋਂਕਿ ਇਹ ਸਟਰੀਮਿੰਗ ਸੇਵਾ ਦੇ ਵਿੱਚ ਅਸੀਂ ਜਦੋਂ ਮਰਜ਼ੀ ਉਹ ਗਾਣੇ ਡੈਲੀਟ ਵੀ ਕਰ ਸਕਦੇ ਅਤੇ ਨਵੇਂ ਗਾਣੇ ਭਰ ਵੀ ਸਕਦੇ ਹੈ ਅਤੇ ਉਹ ਵਧੀਆ ਗਾਣਿਆਂ ਦਾ ਅਸੀਂ ਲੁੱਤਫ਼ ਵੀ ਉਠਾ ਸਕਦੇ ਹਾਂ ਜਿਹੜਾ ਵੀ ਨਵਿਆ ਗਾਣਾ ਮਾਰਕੀਟ ਵਿੱਚ ਆ ਜਾਂਦਾ ਹੈ ਉਹ ਇਸ ਸੇਵਾ ਰਾਹੀਂ ਅਸੀਂ ਦੁਬਾਰਾ ਸੁਣ ਵੀ ਸਕਦੇ ਹਾਂ ਅਤੇ ਉਹਨੂੰ ਡਾਊਨਲੋਡ ਕਰਕੇ ਅਸੀਂ ਦੁਬਾਰਾ ਵੀ ਸੁਣ ਸਕਦੇ ਹਾਂ ਇਹ ਨਹੀਂ ਕਿ ਉਹ ਉਸੇ ਵੇਲੇ ਤੱਕ ਹੀ ਹੋਏਗਾ ਅਸੀਂ ਡਾਊਨਲੋਡ ਕਰਕੇ ਕਾਫੀ ਕੁਛ ਸਿੱਖ ਸਕਦੇ ਹਾਂ ਜਦੋਂ ਕਿ ਭੌਤਿਕ ਸੀ ਡੀ ਰਾਹੀਂ ਅਸੀਂ ਸਿਰਫ ਉਹ ਲਿਮਿਟਡ ਗਾਣੇ ਹੀ ਸੁਣ ਸਕਦੇ ਹਾਂ